ਬਦਲਦੇ ਮੌਸਮ ਦਾ ਖੇਤਰ ਅਤੇ ਖੇਤੀ 'ਤੇ ਬਹੁਤ ਅਸਰ ਪੈਂਦਾ ਹੈ ਜਿਵੇਂ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਟੈਂਪਰੇਚਰ ਵੱਧ ਰਿਹਾ ਹੈ ਅਤੇ ਉਹਦੇ ਕਰਕੇ ਜਿਵੇਂ ਅਜੋਕੇ ਸਮੇਂ ਦੇ ਵਿੱਚ ਸਾਡੇ ਇੱਧਰ ਖੇਤਰ ਦੇ ਵਿੱਚ ਹੜ੍ਹ ਆਏ ਸਨ ਜਿਸ ਕਰਕੇ ਕਿਸਾਨਾਂ ਦੀ ਸਾਰੀ ਫਸਲ ਤਬਾਹ ਹੋ ਗਈ ਸੀ ਅਤੇ ਸਾਰੇ ਲੋਕਾਂ ਦੀਆਂ ਜਾਨਾਂ ਦਾ ਖਤਰਾ ਵੀ ਬਣ ਗਿਆ ਸੀ ਜਿਸ ਕਰਕੇ ਸਾਰੇ ਹੀ ਬਹੁਤ ਨਾ ਉਮੀਦ ਹੋ ਗਈ ਸੀਗੇ ਅਤੇ ਘਰ ਵਿੱਚ ਖਾਣ ਲਈ ਕੋਈ ਅੰਨ ਨਹੀਂ ਸੀਗਾ ਜਿਸ ਨੂੰ ਦੇਖਦੇ ਹੋਏ ਸਰਕਾਰ ਨੇ ਉਹਨਾਂ ਨੂੰ ਅੰਨ ਦਿੱਤਾ ਸੀ ਅਤੇ ਲੋਕਾਂ ਨੇ ਸਭ ਦੀ ਹੈਲਪ ਕੀਤੀ ਸੀ ਜਿਹੜੇ ਏਰੀਆ ਦੇ ਵਿੱਚ ਹੜ੍ਹ ਆਏ ਸੀ ਦੁ ਦੂਸਰਿਆਂ ਨੇ ਉਹਨਾਂ ਨੂੰ ਤੱਕ ਅੰਨ ਪਹੁੰਚਾਇਆ ਸੀਗਾ ਅਤੇ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਉਹਨਾਂ ਨੂੰ ਪੈਸੇ ਦਵੇ ਤਾਂ ਜੋ ਉਹ ਆਪਣੀ ਨਵੀਂ ਫਸਲ ਖਰੀਦ ਸਕਣ ਅਤੇ ਉਹਨੂੰ ਲਾ ਸਕਣ ਤਾਂ ਜੋ ਜੋ ਤੰਗੀ ਆਈ ਹੈ ਅਤੇ ਉਹਦੇ ਨਾਲ ਨਜਿੱਠਿਆ ਜਾ ਸਕੇ ਜਿਸ ਇਹਦੇ ਕਰਕੇ ਸਾਨੂੰ ਚਾਹੀਦਾ ਹੈ ਕਿ ਅਸੀਂ ਘੱਟ ਤੋਂ ਘੱਟ